ਵੈਸੇ ਤਾਂ ਮੈਂ ਬਹੁਤ ਜਗ੍ਹਾ 'ਤੇ ਘੁੰਮਦਾ ਰਹਿੰਦਾ ਜਿਵੇਂ ਕਿ ਘੁੰਮਦਾ ਵੀ ਰਹਿੰਦਾ ਅਤੇ ਮੈਂ ਫੋਟੋਆਂ ਵੀ ਕਲਿੱਕ ਕਰਦਾ ਰਹਿੰਦਾ ਜੇ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਮੇਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਅਤੇ ਇੱਥੇ ਮੇਨ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਠੰਡਾ ਬੁਰਜ ਜੋਤੀ ਸਰੂਪ ਗੁਰਦੁਆਰਾ ਅਤੇ ਆਮ ਖਾਸ ਬਾਗ ਹੈ ਇੱਥੇ ਫੋਟੋ ਕਲਿੱਕ ਕਰਦਾ ਰਹਿੰਦਾ ਅਤੇ ਸਾਡਾ ਇੱਕ ਖੰਨਾ ਸ਼ਹਿਰ ਖੰਨੇ ਸ਼ਹਿਰ ਦੇ ਵਿੱਚ ਦੀ ਗੱਲ ਕਰਾਂ ਤਾਂ ਉੱਥੇ ਇੱਕ ਮੈਕਡੋਨਲ ਹੈ ਮੈਕਡੋਨਲ ਅਤੇ ਫੋਟੋਆਂ ਕਲਿੱਕ ਕਰਦਾ ਹਾਂ ਅਤੇ ਚੰਡੀਗੜ੍ਹ ਲੁਧਿਆਣਾ ਹਾਈਵੇ 'ਤੇ ਇੱਕ ਰਾਜਾ ਢਾਬਾ ਹੈ ਅਤੇ ਉੱਥੇ ਵੀ ਫੋਟੋਆਂ ਕਲਿੱਕ ਕਰੀ ਕਰ ਲਈਦੀਆਂ ਨੇ ਅਤੇ ਜੇ ਚੰਡੀਗੜ੍ਹ ਜਾਈਏ ਤਾਂ ਚੰਡੀਗੜ੍ਹ ਦੇ ਵਿੱਚ ਸਤਾਰ੍ਹਾਂ ਸੈਕਟਰ ਜਿਵੇਂ ਕਿ ਅਲਾਂਟੇ ਮੌਲ ਹੋ ਗਿਆ ਉੱਥੇ ਫੋਟੋਆਂ ਕਲਿੱਕ ਕਰਦੇ ਰਹਿੰਦੇ ਹਾਂ ਜਿਵੇਂ ਰੋਜ਼ ਗਾਰਡਨ ਹੋ ਗਿਆ ਰੋਗ ਗਾਰਡਨ ਹੋ ਗਿਆ ਸੁਖਮਨਾ ਝੀਲ ਹੋ ਗਈ ਅਤੇ ਪੰਜਾਬ ਵਿੱਚ ਇੱਕ ਫੇਮਸ ਜਗ੍ਹਾ ਆਪਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਉੱਥੇ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਉੱਥੇ ਵੀ ਫੋਟੋਆਂ ਵਗੈਰਾ ਕਲਿੱਕ ਕਰਦੇ ਹਾਂ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਇੱਕ ਅਜੂਬਾ ਬਣਿਆ ਹੋਇਆ ਹੈ ਅਤੇ ਉੱਥੇ ਵੀ ਫੋਟੋਆਂ ਵਗੈਰਾ ਕਲਿੱਕ ਕਰਦੇ ਹਾਂ ਜੇ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਸ਼ਿਮਲੇ ਮਨਾਲੀ ਜਾਂ ਧਰਮਸ਼ਾਲਾ ਦੇ ਵਿੱਚ ਜਾਂਦੇ ਹਾਂ ਉਧਰ ਪਹਾੜੀ ਏਰੀਆ ਹੈ ਬਹੁਤ ਵਧੀਆ ਏਰੀਆ ਹੈ ਅਤੇ ਉੱਥੇ ਵੀ ਫੋਟੋਆਂ ਵਗੈਰਾ ਅਸੀਂ ਕਲਿੱਕ ਕਰਦੇ ਰਹਿੰਦੇ ਹਾਂ